ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਮੈਂ ਆਈ ਟੀ ਆਈ ਬੁਢਲਾਡਾ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਉਸ ਵੇਲੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਖ ਵੱਖ ਕਲਾਕਾਰਾਂ ਨੇ ਵੱਖ ਵੱਖ ਲੋਕਾਂ ਨੇ ਗਾਇਕੀ ਦਾ ਪ੍ਰਦਰਸ਼ਨ ਕਰਨਾ ਸੀ ਇਹ ਪ੍ਰੋਗਰਾਮ ਸਾਡੇ ਬਲਾਡੇ ਨੇੜੇ ਸਰਕਾਰੀ ਸਕੂਲ ਮੇਰਾ ਮੇਅ ਬੀ ਲੜਕੀਆਂ ਦੇ ਸਕੂਲ ਵਿੱਚ ਹੋਇਆ ਸੀ ਉਸ ਸਮੇਂ ਮੈਂ ਆਈ ਟੀ ਆਈ ਦੇ ਵਿੱਚ ਰੇਡੀਓ ਟੀਵੀ ਦਾ ਡਿਪਲੋਮਾ ਕਰਦਾ ਹੁੰਦਾ ਸੀ ਤਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਮੇਰੇ ਨਾਲ ਦਾ ਇੱਕ ਮੁੰਡਾ ਆਈ ਟੀ ਆਈ ਦੇ ਵਿੱਚ ਪੜ੍ਹਦਾ ਹੁੰਦਾ ਸੀ ਬਲਵੀਰ ਚੋਟੀਆਂ ਉਹ ਵੀ ਕਾਫੀ ਬਹੁਤ ਜ਼ਿਆਦਾ ਵਧੀਆ ਗਾਉਂਦਾ ਹੁੰਦਾ ਸੀ ਜਦੋਂ ਸਟੇਜ ਦੇ ਉੱਤੇ ਸਟੇਜ ਸੈਕਟਰੀ ਨੂੰ ਅਸੀਂ ਆਪਣੇ ਨਾਮ ਲਿਖਵਾਏ ਤਾਂ ਬਲਵੀਰ ਚੋਟੀਆਂ ਨਾਮ ਵੀ ਉਹਦੇ ਵਿੱਚ ਸ਼ਾਮਿਲ ਸੀ ਮੇਰਾ ਦੋਸਤ ਵੀ ਸੀ ਵੈਸੇ ਉਹ ਪਰ ਜਦੋਂ ਮੇਰੀ ਵਾਰੀ ਆਉਣ ਤੋਂ ਪਹਿਲਾਂ ਉਹਨੇ ਗਾਇਆ ਤਾਂ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਇਸ ਮੁਕਾਬਲੇ ਵਿੱਚ ਪਹਿਲੇ ਨੰਬਰ 'ਤੇ ਨਾ ਆ ਸਕਾਂ ਪਰ ਕੁਦਰਤ ਦਾ ਕ੍ਰਿਸ਼ਮਾ ਕਹਿ ਲਓ ਜਾਂ ਦੇਣ ਕਹਿ ਲਓ ਜਾਂ ਗਲੇ ਦੇ ਵਿੱਚ ਸਰਸਵਤੀ ਦਾ ਵਾਸ ਕਹਿ ਲਓ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਜਦੋਂ ਮੈਂ ਆਪਣੀ ਪਰਫੋਰਮੈਂਸ ਦਿੱਤੀ ਆਪਣਾ ਗੀਤ ਗਾਇਆ ਸਟੇਜ 'ਤੇ ਤਾਂ ਮੇਰੇ ਗੀਤ ਤੋਂ ਬਾਅਦ ਬਹੁਤ ਹੀ ਜ਼ਿਆਦਾ ਤਾੜੀਆਂ ਪਈਆਂ ਅਤੇ ਮੈਨੂੰ ਲੱਗਿਆ ਕਿ ਮੈਂ ਬਹੁਤ ਵਧੀਆ ਗਾਇਆ ਹੈ ਸਮਾਂ ਲੰਘਦਾ ਰਿਹਾ ਕਈ ਕਲਾਕਾਰ ਆਏ ਕਈ ਗਾਉਂਦੇ ਰਹੇ ਅਤੇ ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ ਰਿਜ਼ਲਟ ਦੀ ਉਡੀਕ ਕਰਦੇ ਰਹੇ ਕਿ ਕਦੋਂ ਇਸ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ ਕਦੋਂ ਦੱਸਿਆ ਜਾਵੇ ਕਿਉਂਕਿ ਪਹਿਲੇ ਨੰਬਰ ਦੂਜੇ ਤੀਜੇ 'ਤੇ ਕੌਣ ਆਵੇਗਾ ਤਾਂ ਮੈਂ ਆਪ ਹੈਰਾਨ ਹੋ ਗਿਆ ਜਦੋਂ ਨਤੀਜਾ ਘੋਸ਼ਿਤ ਕਰਨ ਵਾਲੇ ਬੰਦੇ ਨੇ ਬੋਲਿਆ ਤੀਜੇ ਨੰਬਰ 'ਤੇ ਗੁਰਦਿੱਤ ਸਿੰਘ ਦੂਜੇ ਨੰਬਰ 'ਤੇ ਬਲਵੀਰ ਸਿੰਘ ਅਤੇ ਅਖੀਰ ਵਿੱਚ ਦਿਲ ਦੀਆਂ ਧੜਕਣਾਂ ਨੂੰ ਰੋਕਦੇ ਹੋਏ ਪਹਿਲੇ ਨੰਬਰ ਦਾ ਇੰਤਜ਼ਾਰ ਕਰਨ ਲੱਗੇ ਤਾਂ ਉਹਨਾਂ ਨੇ ਬੜੇ ਹੀ ਉੱਚੇ ਸੁਰ ਵਿੱਚ ਬੋਲਿਆ ਅਤੇ ਪਹਿਲੇ ਨੰਬਰ 'ਤੇ ਜਸਵੀਰ ਸਿੰਘ ਪਿੰਡ ਹੋਡਲਾ ਤਾਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਿਆ ਮੈਂ ਆਪਣੀ ਖੁਸ਼ੀ ਦਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮੈਂ ਇੰਨਾਂ ਜ਼ਿਆਦਾ ਖੁਸ਼ ਹੋਇਆ ਅਤੇ ਮੇਰੇ ਜਿਹੜੇ ਯਾਰ ਦੋਸਤ ਸੀ ਮੇਰੀ ਜੁੰਡਲੀ ਦੇ ਯਾਰ ਸੀ ਜਿਹੜੇ ਉਹਨਾਂ ਨੇ ਮੈਨੂੰ ਹੱਥਾਂ 'ਤੇ ਚੱਕ ਲਿਆ ਅਤੇ ਉਹਨਾਂ ਨੇ ਉਸ ਵੇਲੇ ਪਾਰਟੀ ਵੀ ਕੀਤੀ ਜਸ਼ਨ ਵੀ ਮਨਾਏ ਗਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਵੇਲੇ ਦਾ ਜਿਹਨਾਂ ਨੇ ਮੈਨੂੰ ਆਈ ਟੀ ਆਈ ਦੇ ਵਿੱਚ ਇੰਨਾਂ ਕੁ ਜ਼ਿਆਦਾ ਮਸ਼ਹੂਰ ਕਰਤਾ ਬੁਲੰਦੀਆਂ 'ਤੇ ਪਹੁੰਚਾ ਤਾ ਅਤੇ ਉਸ ਤੋਂ ਬਾਅਦ ਮੇਰੀ ਪਹਿਚਾਣ ਇੱਕ ਗਾਇਕ ਵਜੋਂ ਹੋਣੀ ਸ਼ੁਰੂ ਹੋ ਗਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ